ਮੈਨੂੰ ਸੋਸ਼ਲ ਮੀਡੀਆ 'ਤੇ ਡਾਂਸ ਕਰਨਾ ਬਿਲਕੁਲ ਵੀ ਪਸੰਦ ਨਹੀਂ ਹੈ

ਮੈਂ ਜਦੋਂ ਵੀ ਸਕੂਲ ਵਿੱਚ ਕੋਈ ਵੀ ਪਾਰਟੀਸਪੇਸ਼ਨ ਹੁੰਦੀ ਹੈ ਮੈਂ ਹਮੇਸ਼ਾ ਉਸ ਵਿੱਚ ਹਿੱਸਾ ਲੈਂਦੀ ਹਾਂ ਕਈ ਵਾਰ ਤਾਂ ਮੇਰੀ ਪੁਜੀਸ਼ਨ ਵੀ ਇਸ ਵਿੱਚ ਆਉਂਦੀ ਹੈ ਮੈਂ ਡਾਂਸ ਗਿੱਦਾ ਬੋਲੀਆਂ ਇਹ ਸਭ ਵਿੱਚ ਹਿੱਸਾ ਲੈਂਦੀ ਹਾਂ ਛੋਟੀ ਹੁੰਦਿਆਂ ਮੈਂ ਇੱਕ ਐਨੂਅਲ ਫੰਕਸ਼ਨ 'ਚ ਹਿੱਸਾ ਲਿਆ ਸੀ ਉਸ ਵਿੱਚ ਵੀ ਮੇਰੀ ਪਰਫੋਰਮੈਂਸ ਬਹੁਤ ਵਧੀਆ ਗਈ ਸੀ ਅਤੇ ਹੁਣ ਕਾਲਜ ਵਿੱਚ ਵੀ ਹਿੱਸਾ ਲੈਂਦੀ ਹਾਂ ਮੈਨੂੰ ਡਾਂਸ ਕਰਨਾ ਬਹੁਤ ਵਧੀਆ ਲੱਗਦਾ ਹੈ ਮੈਂ ਜਦੋਂ ਵੀ ਵਿਹਲੀ ਹੁੰਦੀ ਹਾਂ ਕਦੇ ਤਾਂ ਮੈਂ ਡਾਂਸ ਕਰ ਲੈਂਦੀ ਹਾਂ ਮੈਂ ਆਪਣਾ ਡਾਂਸ ਨਾਲ ਟਾਈਮ ਵਧੀਆ ਸਪੈਂਡ ਕਰਦੀ ਹਾਂ ਜੇ ਵੇਖਿਆ ਜਾਵੇ ਇਸ ਇਹ ਵਧੀਆ ਹੁੰਦਾ ਜਾਂ ਨਹੀਂ ਮੇਰਾ ਮੰਨਣਾ ਹੈ ਕਿ ਇਹ ਚੀਜ਼ ਆਪਣੀ ਇੱਕ ਪਰਸਨਲ ਚੀਜ਼ ਜੋ ਰਹਿਣੀ ਚਾਹੀਦੀ ਹੈ ਕਿਸੇ ਨੂੰ ਦਿਖਾਵਾ ਨਹੀਂ ਕਰਨਾ ਚਾਹੀਦਾ ਇਸ ਚੀਜ਼ ਦਾ